ਮੇਰੀ ਸਭ ਤੋਂ ਮਨ ਪਸੰਦ ਫੋਟੋਗ੍ਰਾਫੀ ਦੇ ਵਿੱਚੋਂ ਜੋ ਮੈਨੂੰ ਸਭ ਤੋਂ ਸੋਹਣੀ ਲੱਗੀ ਉਹ ਹੈ ਜੰਮੂ ਕਸ਼ਮੀਰ ਵਿੱਚ ਸਥਿਤ ਸ਼੍ਰੀਨਗਰ ਵਿਖੇ ਗੁਲ ਮਾਰਗ ਦੀ ਬਰਫ ਵਾਲੀ ਫੋਟੋ ਜਿਸ ਦੇ ਪਿਛਲੀ ਕਹਾਣੀ ਇਹ ਹੈ ਕਿ ਮੈਂ ਜਦੋਂ ਆਪਣੇ ਵਿਆਹ ਤੋਂ ਬਾਅਦ ਉੱਥੇ ਹਨੀਮੂਨ ਨੂੰ ਮਨਾਉਣ ਲਈ ਆਪਣੇ ਘਰ ਵਾਲੇ ਦੇ ਨਾਲ ਗਈ ਅਤੇ ਉੱਥੇ ਮੈਨੂੰ ਗੁਲ ਮਰਗ ਵਿੱਚ ਬਰਫ ਦਾ ਬਹੁਤ ਹੀ ਜਿਵੇਂ ਕਿ ਮੈਂ ਸ਼ੌਕੀਨ ਹਾਂ ਅਤੇ ਉੱਥੇ ਉਹ ਇੱਕ ਇੱਕ ਔਰਤ ਸੀ ਜਿਸ ਨੂੰ ਕਿ ਅਸੀਂ ਆਪਣਾ ਕੈਮਰਾ ਫੜਾਇਆ ਅਤੇ ਬਹੁਤ ਹੀ ਵੰਨ ਸਵੰਨੀਆਂ ਪੋਸ ਅਤੇ ਆਪਣੀਆਂ ਫੋਟੋਆਂ ਜਿਹੜੀਆਂ ਹੈ ਤਸਵੀਰਾਂ ਉੱਥੇ ਖਿੱਚੀਆਂ ਫਿਰ ਉਸ ਔਰਤ ਨੂੰ ਅਸੀਂ ਕਿਹਾ ਕਿ ਬਰਫ 'ਤੇ ਵੱਡਾ ਜਿਹਾ ਸਨੋਮੈਨ ਵੀ ਆਪਾਂ ਬਣਵਾ ਕੇ ਉਸ ਕੋਲੋਂ ਅਸੀਂ ਤਸਵੀਰਾਂ ਖਿਚਵਾਈਆਂ ਅਤੇ ਬਾਅਦ ਵਿੱਚ ਅਸੀਂ ਉੱਥੇ ਕਾਫੀ ਤਸਵੀਰਾਂ ਦੇ ਨਾਲ ਨਾਲ ਫੋਟੋ ਸ਼ੂਟ ਵੀ ਕੀਤਾ